ਮੋਬਾਇਲ ਗੇਮਿੰਗ ਦੇ ਵੱਧਦੇ ਉਭਾਰ ਨੇ ਉਦਯੋਗ ਉੱਤੇ ਬਹੁਤ ਹੀ ਮਾੜਾ ਪ੍ਰਭਾਵ ਪਾਇਆ ਹੈ ਕਿਉਂਕਿ ਅੱਜ ਕੱਲ੍ਹ ਦੇ ਬੱਚੇ ਗਰਾਊਂਡ ਦੇ ਵਿੱਚ ਖੇਲਣ ਨਾਲੋਂ ਮੋਬਾਈਲ ਉੱਤੇ ਗੇਮਾਂ ਖੇਡਣੀਆਂ ਪਸੰਦ ਕਰਦੇ ਹਨ ਉਦਯੋਗ ਦੇ ਵਿੱਚ ਬਣਨ ਵਾਲੇ ਸਮਾਨ ਦੀ ਮਾਤ ਗਿਣਤੀ ਬਹੁਤ ਘੱਟ ਗਈ ਹੈ ਕਿਉਂਕੀ ਅੱਜ ਕੱਲ੍ਹ ਬੱਚੇ ਉਹ ਚੀਜਾਂ ਲੈਣੀਆਂ ਨਹੀਂ ਪਸੰਦ ਕਰਦੇ ਜੋ ਕਿ ਗਰਾਊਂਡ ਦੇ ਵਿੱਚ ਵਰਤੀਆਂ ਜਾਂਦੀਆਂ ਹਨ ਉਹ ਮੋਬਾਈਲ ਉੱਤੇ ਗੇਮਾਂ ਹੀ ਖੇਡਣੀਆਂ ਪਸੰਦ ਕਰਦੇ ਹਨ ਜਿਨ੍ਹਾਂ ਕਰਕੇ ਉਹਨਾਂ ਦੇ ਉੱਤੇ ਵੀ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ ਗਰਾਊਂਡ ਦੇ ਵਿੱਚ ਖੇਲਣ ਨਾਲ ਬੱਚਿਆਂ ਦੇ ਸਿਹਤ ਅਤੇ ਦਿਮਾਗ ਉੱਤੇ ਵਧੀਆ ਅਸਰ ਪੈਂਦਾ ਹੈ ਇਸਦੇ ਨਾਲ ਨਾਲ ਇਸਦੀ ਕਮੀ ਦੇ ਕਰਕੇ ਉਦਯੋਗ ਉੱਤੇ ਵੀ ਬਹੁਤ ਹੀ ਮਾੜਾ ਪ੍ਰਭਾਵ ਪਿਆ ਹੈ